ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਵੈਸੇ ਤਾਂ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਬਚਪਨ ਤੋਂ ਹੀ ਸੀ ਮੈਂ ਸਕੂਲ ਵਿੱਚ ਵੀ ਆਪਣੇ ਫਰੀ ਸਮੇਂ ਵਿੱਚ ਲਾਇਬਰੇਰੀ ਜਾ ਕੇ ਕਿਤਾਬਾਂ ਪੜ੍ਹਦੀ ਸੀ ਅਤੇ ਕਾਲੇਜ ਵਿੱਚ ਵੀ ਆਪਣੇ ਫਰੀ ਟਾਈਮ ਦਾ ਇਸਤੇਮਾਲ ਲਾਇਬਰੇਰੀ ਜਾ ਕੇ ਅਲੱਗ ਅਲੱਗ ਪ੍ਰਕਾਰ ਦੀਆਂ ਕਿਤਾਬਾਂ ਪੜ੍ਹਨ ਵਿਚ ਕਰਦੀ ਸੀ ਮੈਨੂੰ ਇੰਨਸਾਇਕਲੋਪੀਡੀਆ ਵਿੱਚ ਬਹੁਤ ਹੀ ਜ਼ਿਆਦਾ ਇੰਟਰਸਟ ਹੈ ਮੈਂ ਇੰਨਸਾਇਕਲੋਪੀਡੀਆ ਦੀ ਹਰ ਇੱਕ ਕਿਤਾਬ ਪੜ੍ਹੀ ਹੋਈ ਹੈ ਇਸ ਵਿੱਚ ਸਾਨੂੰ ਹਰ ਇੱਕ ਚੀਜ਼ ਬਾਰੇ ਪਤਾ ਲੱਗ ਜਾਦਾ ਹੈ ਜਿਸ ਇਸ ਵਿੱਚ ਹਰ ਇੱਕ ਚੀਜ਼ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਜਾਂਦਾ ਹੈ ਜਿਵੇਂ ਔਨਲਾਈਨ ਵਿੱਚ ਵਿਕੀਪੀਡੀਆ ਹੈ ਉੱਦਾਂ ਹੀ ਔਫਲਾਈਨ ਵਿੱਚ ਇੰਨਸਾਇਕਲੋਪੀਡੀਆ ਹੁੰਦਾ ਹੈ ਧੰਨਵਾਦ